ਸਾਡੇ ਇਲਾਕੇ ਵਿੱਚ ਜ਼ਿਆਦਾਤਰ ਨਸ਼ੇ ਖੋਰੀ ਦਾ ਅਪਰਾਧ ਹੋ ਰਿਹਾ ਹੈ ਲੋਕ ਸ਼ਰਾਬਾ ਪੀਂਦੇ ਹਨ ਜਾਂ ਨਸ਼ੇ ਕਰਦੇ ਹਨ ਜੋ ਕਿ ਬਹੁਤ ਹੀ ਗਲਤ ਹੈ ਇਸ ਨਾਲ ਅੱਜ ਕੱਲ੍ਹ ਦੇ ਨੌਜਵਾਨ ਆਪਣੇ ਅ ਭਵਿੱਖ ਤੋਂ ਗਲਤ ਰਾਹ ਪੈ ਕੇ ਆਪਣੇ ਭਵਿੱਖ ਨੂੰ ਖ਼ਤਮ ਕਰ ਰਹੇ ਹਨ ਆਪਣੇ ਪਰਿਵਾਰ ਦਾ ਅ ਪਰਿਵਾਰ ਦਾ ਧਿਆਨ ਨਾ ਰੱਖ ਕੇ ਇੱਧਰ ਉੱਧਰ ਦੀਆਂ ਗਲੀਆਂ ਵਿੱਚ ਫਿਰ ਕੇ ਨਸ਼ੇ ਦੀ ਸ਼ੁਲ ਦੇ ਵਿੱਚ ਨਸ਼ੇ ਨੂੰ ਲੱਭਦੇ ਫਿਰਦੇ ਹਨ ਜੋ ਕਿ ਬਹੁਤ ਹੀ ਗਲਤ ਹੈ ਇਹ ਜ਼ਿਆਦਾਤਰ ਬੇਰੁਜ਼ਗਾਰੀ ਕਾਰਨ ਹੈ ਲੋਕ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਕੰਮ ਨਾ ਮਿਲਣ ਕਰਕੇ ਉਹ ਡਿਪਰੈਸ਼ਨ ਦੇ ਵਿੱਚ ਜਾਂਦੇ ਹਨ ਜਿਸ ਕਾਰਨ ਉਹ ਨਸ਼ੇ ਦੇ ਵੱਲ ਲੱਗ ਜਾਂਦੇ ਹਨ ਜੋ ਕਿ ਬਹੁਤ ਹੀ ਗਲਤ ਗਲਤ ਢੰਗ ਹੈ ਨਸ਼ੇ ਵਿੱਚ ਲੱਗ ਕੇ ਉਹ ਆਪਣੇ ਘਰਦਿਆਂ ਨੂੰ ਗਲਤ ਮਲ ਗਲਤ ਸ਼ਬਦ ਬੋਲਦੇ ਹਨ ਆਪਣੇ ਘਰਦਿਆਂ ਦੀ ਪਰਵਾਹ ਨਹੀਂ ਕਰਦੇ ਦੇਰ ਰਾਤ ਤੱਕ ਘਰੋਂ ਬਾਹਰ ਰਹਿੰਦੇ ਹਨ ਨਾ ਕੋਈ ਕੰਮ ਕਰਦੇ ਹਨ ਨਾ ਕੋਈ ਕਾਰ ਕਰਦੇ ਹਨ ਘਰਦਿਆਂ ਨੂੰ ਖਾ ਖਾਣ ਪੀਣ ਦੀ ਵੀ ਦਿੱਕਤ ਹੁੰਦੀ ਹੈ ਇਸ ਲਈ ਸਾਨੂੰ ਜਿੰਨਾ ਹੋ ਸਕੇ ਇੱਦਾਂ ਦੇ ਨੌਜਵਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਨਸ਼ੇ ਨੂੰ ਛੱਡ ਕੇ ਬੇਰੋਜ਼ਗਾਰੀ ਨੂੰ ਖ਼ਤਮ ਕਰਨ ਅਤੇ ਕਿਸੇ ਕੰਮ ਧੰਦੇ ਵੱਲ ਲੱਗਣ ਸਰਕਾਰ ਨੇ ਨਸ਼ੇ ਨੂੰ ਛੁਡਾਉਣ ਵਾਸਤੇ ਕਾਫੀ ਸਾਰੇ ਨਸ਼ਾ ਮੁਕਤ ਕੇਂਦਰ ਵੀ ਬਣਾਏ ਹਨ ਜੋ ਕਿ ਬਹੁਤ ਵਧੀਆ ਪਹਿਲ ਹੈ ਪਰ ਇਹ ਕਈ ਨੌਜਵਾਨ ਇੱਦਾਂ ਦੇ ਹਨ ਜੋ ਆਪਣੇ ਘਰਦਿਆਂ ਦੀਆਂ ਗੱਲਾਂ ਨਹੀਂ ਮੰਨਦੇ ਅਤੇ ਸੰਸ ਅ ਸੰਸਥਾ ਦਾ ਪ੍ਰਯੋਗ ਨਹੀਂ ਕਰਦੇ ਜਿਨਾਂ ਨੂੰ ਰੋਕਣ ਲਈ ਸਾਨੂੰ ਹ ਜਿਨ੍ਹਾਂ ਨੂੰ ਰੋਕਣ ਲਈ ਸਾਨੂੰ ਹਰ ਸੰਭਵ ਤੋਂ ਸੰਭਵ ਪਰਿਆਸ ਕਰਨਾ ਚਾਹੀਦਾ ਹੈ ਧੰਨਵਾਦ